ਸਰ ਸਤਿ ਸ਼੍ਰੀ ਅਕਾਲ ਸਰ ਮੈਂ ਅਰਸ਼ ਬੋਲਦਾ ਸੀਗਾ ਸਰ ਮੈਂ ਕਹਿੰਦਾ ਸੀਗਾ ਤੁਸੀਂ ਆਓ ਸਾਡੇ ਘਰੇ ਫੰਕਸ਼ਨ ਜਿਹਾ ਸੀਗਾ ਆਪਣੇ ਇੱਕ ਛੋਟਾ ਜਿਹਾ ਫੈਮਲੀ ਫੰਕਸ਼ਨ ਨਹੀਂ ਸਰ ਐਤਵਾਰ ਨੂੰ ਆ ਸਰ ਹਾਂਜੀ ਔਰ ਸਰ ਇਹ ਹੈਗਾ ਵਾ ਆਪਣਾ ਸ਼ਾਮ ਨੂੰ ਆ ਮਤਲਬ ਵੀ ਰਾਤ ਦੀ ਪਾਰਟੀ ਆ ਛੋਟੀ ਜਿਹੀ ਸ਼ਾਮ ਨੂੰ ਮਤਲਬ ਕਿ ਛੇ ਸੱਤ ਵਜੇ ਦਾ ਟਾਈਮ ਅੱਛਾ ਸਰ ਅੱਛਾ ਹਾਂਜੀ ਸਰ ਸਰ ਪ੍ਰੋਗਰਾਮ ਟਾਈਮ ਨਾ ਅਸਲ 'ਚ ਪਹਿਲਾਂ ਹੀ ਫਿਕਸ ਕੀਤਾ ਹੋਇਆ ਸਾਰਿਆਂ ਨੂੰ ਦੱਸਿਆ ਉਦਾਂ ਹੀ ਪਰ ਕਈਆਂ ਦਾ ਕਈਆਂ ਨੂੰ ਸਰ ਇਹ ਹੀ ਪ੍ਰੋਬਲਮ ਆਈ ਆ ਕਿ ਹਾਂ ਟਰੈਫਿਕ ਆ ਅਤੇ ਉਹ ਕਹਿੰਦੇ ਸੀਗੇ ਚਲੋ ਕੋਈ ਨਹੀਂ ਐਡਜਸਟ ਕਰਾਂਗੇ ਪਹਿਲਾਂ ਆਉਣ ਲਈ ਅੱਛਾ ਸਰ ਹਾਂਜੀ ਉਹੀ ਤਾਂ ਹੈ ਸਰ ਪਰ ਸਰ ਅੱਜ ਕੱਲ੍ਹ ਨਾ ਉਹਨੂੰ ਟਰੈਫਿਕ ਨੂੰ ਕੰਟਰੋਲ ਕਰਨ ਲਈ ਆਪਣੇ ਈ ਚਲਾਣ ਕਰ ਦਿੱਤੇ ਗਏ ਨੇ ਸਰ ਜਿਵੇਂ ਹੁਣ ਥਾਂ ਹੋਵੇ ਜਾਮ ਲੱਗ ਜਾਂਦੇ ਸੀਗੇ ਉਹ ਚੀਜ਼ ਨੂੰ ਥੋੜ੍ਹੀ ਘੱਟ ਦਿੰਦੇ ਨੇ ਹਾਂਜੀ ਹਾਂਜੀ ਸਰ ਹਾਂਜੀ ਉਹੀ ਤਾਂ ਹੈ ਸਰ ਉਹਦੇ ਕਰਕੇ ਅਤੇ ਇਹਨਾਂ ਨੇ ਪੂਰੇ ਲੁਧਿਆਣੇ ਦੇ ਵਿੱਚ ਈ ਚਲਾਨ ਨੂੰ ਛੱਬੀ ਜਨਵਰੀ ਤੋਂ ਸਰ ਕੀਤਾ ਕੱਲ੍ਹ ਅਤੇ ਕੱਲ੍ਹ ਦਿਨ ਸੀਗਾ ਛੱਬੀ ਜਨਵਰੀ ਦਾ ਕੱਲ੍ਹ ਤੱਕ ਅਪਲਾਈ ਕੀਤਾ ਸਰ ਹਾਂਜੀ ਸਰ ਹਾਂਜੀ ਹਾਂਜੀ ਇਸ ਲਈ ਸਪੀਡ ਲਿਮਿਟ ਆਪਣੇ ਹਾਂਜੀ ਸਪੀ ਆਹ ਬੈਲਟ ਆਪਣੀ ਸਰ ਸੀਟ ਬੈਲਟ ਸਾਰਾ ਕੁਝ ਸਰ ਸਾਰਾ ਚਲਾਣ ਹੋਇਆ ਕਰੇਗਾ ਅੱਜ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ

ਹਾਂਜੀ ਸਰ ਸਰ ਇੱਕ ਤਾਂ ਨਾ ਉਧਰੋਂ ਫਾਟਕਾਂ ਵੱਲੋਂ ਨੂੰ ਆਇਓ ਸਰ ਉੱਧਰ ਨਾ ਜਾਮ ਲੱਗਿਆ ਰਹਿੰਦਾ ਕਿਉਂਕਿ ਉੱਥੇ ਪਟਰੀਆਂ ਪੈ ਰਹੀਆਂ ਨਵੀਆਂ ਹਾਂਜੀ ਉੱਧਰ ਨਾ ਬਹੁਤ ਜਾਮ ਲੱਗਦਾ ਉਹ ਪਟਰੀਆਂ ਕਰਕੇ ਨਾ ਉਹ ਸਾਰੇ ਘੁੰਮ ਕੇ ਆਉਂਦੇ ਆ ਤਾਂ ਇੱਕੋ ਪਾਸੇ ਜਾਮ ਇਕੱਠਾ ਹੋ ਜਾਂਦਾ ਨਾ ਉੱਥੇ ਕੋਈ ਲਾਈਟਾਂ ਦਾ ਆਪਣਾ ਕੋਈ ਸੀ ਵਗੈਰਾ ਅੱਛਾ ਅੱਛਾ ਹਾਂਜੀ ਸਰ ਉਥੋਂ ਤਾਂ ਠੀਕ ਰਹਿੰਦਾ ਵਾ ਹੋਰ ਸਭ ਸਰ ਵਧੀਆ ਬਸ ਜ਼ਰੂਰ ਆਇਓ ਸਰ ਤੁਸੀਂ ਹਾਂਜੀ ਹਾਂਜੀ ਹਾਂਜੀ ਸਰ ਚਲੋ ਸਰ ਠੀਕ ਹੈ ਫਿਰ ਹਾਂਜੀ ਓਕੇ